ਭੰਗੜਾ ਐਰੋਬਿਕਸ ਵਿੱਚ ਹਿੱਸਾ ਲੈਣ ਨਾਲ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਕਿਵੇਂ ਮਹਿਸੂਸ ਕਰਦੇ ਹੋ ਭੰਗੜੇ ਦਾ ਤਾਂ ਵੈਸੇ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਸਟਾਰਟਿੰਗ ਤੋਂ ਹੀ ਅਤੇ ਮੇਰਾ ਵੇਟ ਓਵਰ ਹੋ ਗਿਆ ਸੀ ਅਤੇ ਮੈਨੂੰ ਮਤਲਬ ਜੋੜਾਂ ਦਾ ਦਰਦ ਵੀ ਬਹੁਤ ਜ਼ਿਆਦਾ ਸੀ ਅਤੇ ਫਿਰ ਮੈਂ ਇਹਦੇ ਨਾਲ ਸਟਰੈਸ ਮਤਲਬ ਕਾਫੀ ਰਹਿਣ ਲੱਗ ਪਿਆ ਸੀ ਮੈਨੂੰ ਅਤੇ ਮੈਂ ਮਤਲਬ ਜਦੋਂ ਸਾ ਮਤਲਬ ਕੋਈ ਕੰਪੀਟੀਸ਼ਨ ਹੋਣਾ ਭੰਗੜੇ ਵਗੈਰਾ ਦਾ ਤਾਂ ਮੈਂ ਉਹਦੇ ਵਿੱਚ ਹੁਣ ਪਾਰਟੀਸਪੇਟ ਕਰਨਾ ਸ਼ੁਰੂ ਕਰਤਾ ਅਤੇ ਪਾਰਟੀਸਪੇਟ ਕਰਨ ਨਾਲ ਥੋੜ੍ਹਾ ਜਿਹਾ ਮਤਲਬ ਜਿੱਦਾਂ ਹੁਣ ਮੇਰਾ ਜੋ ਵੀ ਮਤਲਬ ਹੈ ਸੀ ਮੇਰਾ ਸ਼ੌਂਕ ਸੀਗਾ ਭੰਗੜੇ ਦਾ ਮੈਂ ਭੰਗੜਾ ਸਟਾਰਟ ਕਰਤਾ ਉਹਦੇ ਨਾਲ ਕਾਫੀ ਮੇਰਾ ਵੇਟ ਵੀ ਮਤਲਬ ਸਹੀ ਹੋ ਗਿਆ ਅਤੇ ਉਹਦੇ ਨਾਲ ਕਾਫੀ ਮਤਲਬ ਮਤਲਬ ਮੈਂ ਫਿੱਟ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਪਈ ਲਾਈਫ ਵਿੱਚ ਅੱਛੇ ਦਿਨ ਵੀ ਆਉਂਦੇ ਆ ਬੁਰੇ ਦਿਨ ਵੀ ਆਉਂਦੇ ਆ ਇਹਦੇ ਨਾਲ ਮਤਲਬ ਕਾਫੀ ਮਤਲਬ ਮੈਨੂੰ ਥੋੜ੍ਹਾ ਜਿਹਾ ਉਹ ਹੋ ਗਿਆ ਮੋਟੀਵੇਟ ਮਿਲਿਆ ਮੈਨੂੰ ਅਤੇ ਕਾਫੀ ਮੇਰੀਆਂ ਮੈਡੀਸਨ ਪਹਿਲਾਂ ਚੱਲ ਰਹੀਆਂ ਸੀ ਅਤੇ ਹੁਣ ਮਤਲਬ ਉਹਦੇ ਨਾਲ ਜਦੋਂ ਦਾ ਮੇਰਾ ਵੇਟ ਸਹੀ ਹੋਇਆ ਅਤੇ ਉਹਦੇ ਨਾਲ ਮੇਰੀਆਂ ਕਾਫੀ ਮੈਡੀਸਨ ਵਗੈਰਾ ਵੀ ਮਤਲਬ ਮੇਰੀਆਂ ਬੰਦ ਹੋ ਗਈਆਂ ਅਤੇ ਥੋੜ੍ਹਾ ਮੈਂ ਆਪਣੇ ਆਪ ਨੂੰ ਮਾਇੰਡ ਫਰੀ ਹੋ ਗਈ

ਮਤਲਬ ਅਪ ਕਾਫੀ ਮਤਲਬ ਮਤਲਬ ਫਿੱਟ ਹੋ ਗਈ ਅਤੇ ਸਮਾਰਟ ਵੀ ਮਤਲਬ ਮੈਨੂੰ ਬੱਚੇ ਵੀ ਕਹਿਣ ਲੱਗ ਪਏ ਮੰਮਾ ਤੁਸੀਂ ਹੁਣ ਬਹੁਤ ਸਮਾਰਟ ਲੱਗ ਰਹੇ ਹੋ ਅਤੇ ਬਾਕੀ ਮਤਲਬ ਚਲੋ ਜੋ ਵੀ ਆ ਅੱਛਾ ਹੀ ਮਤਲਬ ਭੰਗੜਾ ਤਾਂ ਵੈਸੇ ਹੀ ਮਤਲਬ ਕਾਫੀ ਮਤਲਬ ਮੈਨੂੰ ਪਸੰਦ ਹੈ